ਡਾਂਸ ਕਰਨਾ ਇੱਕ ਤਰ੍ਹਾਂ ਦਾ ਕਸਰਤ ਹੀ ਹੈ ਇਹ ਸਾਡੇ ਸਿਹਤ ਲਈ ਬਹੁਤ ਹੀ ਚੰਗਾ ਹੁੰਦਾ ਹੈ ਕਿਉਂਕਿ ਡਾਂਸ ਵਿੱਚ ਬਹੁਤ ਸਾਰੇ ਇੱਕ ਅਜਿਹੇ ਸਟੈਪਸ ਹੁੰਦੇ ਹਨ ਜੋ ਸਾਡੀ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ ਜਿਵੇਂ ਅਸੀਂ ਅਲੱਗ ਅਲੱਗ ਤਰ੍ਹਾਂ ਦੀ ਬੋਡੀ ਮੂਵਮੈਂਟ ਕਰਦੇ ਹਾਂ ਜੋ ਕਿ ਸਾਡੇ ਖੂਨ ਦੇ ਵਹਾਅ ਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਬਣਾਈ ਰੱਖਦਾ ਹੈ ਅਤੇ ਬਹੁਤ ਲੋਕਾਂ ਨੂੰ ਡਾਂਸ ਕਰਨ ਨਾਲ ਖੁਸ਼ੀ ਵੀ ਮਿਲਦੀ ਹੈ ਇਹ ਉਨ੍ਹਾਂ ਦੀ ਇੱਕ ਤਰੀਕੇ ਨਾਲ ਹੋਬੀ ਹੁੰਦੀ ਹੈ ਜਿਸ ਨਾਲ ਉਹ ਆਪਣੇ ਆਪ ਵਿੱਚ ਇੱਕ ਤ ਜਦ ਵੀ ਡਾਂਸ ਕਰਦੇ ਹੈ ਤਾਂ ਤਰੋਤਾਜ਼ਾ ਮਹਿਸੂਸ ਕਰਦੇ ਹੈ